ਹੈਲੋ ਸਤਿ ਸ਼੍ਰੀ ਅਕਾਲ ਸਰ ਜੀ ਸਰ ਮੈਂ ਤੁਹਾਡਾ ਗੁਆਂਢੀ ਬੋਲ ਰਿਹਾ ਮੈਂ ਤੁਹਾਡੇ ਨਾਲ ਦਿਆਂ ਕੋਲ ਨੰਬਰ ਲਿਆ ਤੁਹਾਡਾ ਸਰ ਐਕਚੁਲੀ ਮੈਂ ਨਾ ਰੀਸੈਂਟ ਇੱਥੇ ਦਿੱਲੀ ਤੋਂ ਪੰਜਾਬ ਇੱਥੇ ਆਪਣੇ ਤੁਹਾਡੇ ਇਲਾਕੇ ਪਠਾਨਕੋਟ ਸ਼ਿਫਟ ਹੋਇਆ ਹਾਂ ਅਤੇ ਮੈਂ ਹਾਂਜੀ ਮੇਰੇ ਇੱਥੇ ਬਿਜਲੀ ਵਿਭਾਗ ਡਿਪਾਰਟਮੈਂਟ 'ਚ ਨਾ ਤੁਹਾਡੇ ਇਹ ਜੋਬ ਲੱਗੀ ਹੈ ਸਰਕਾਰੀ ਡਿਪਾਰਟਮੈਂਟ 'ਚ

ਸਰ ਇਹ ਹੁਣ ਮੈਂ ਨਵੀਂ ਗੱਡੀ ਲਈ ਆ ਅਤੇ ਗੱਡੀ ਦੀ ਰੈਜਿਸਟ੍ਰੇਸ਼ਨ ਕਰਾਉਣੀ ਹੈ ਹਾਂਜੀ ਹਾਂਜੀ ਅਤੇ ਇਹਦਾ ਕੀ ਹਿਸਾਬ ਕਿਤਾਬ ਆ ਹੁਣ ਕਿੱਥੇ ਹੋਏਗੀ ਪਠਾਨਕੋਟ 'ਚ ਹਾਂਜੀ ਸਰ

ਹਾਂਜੀ

ਕਿਹੜੇ ਸਰ ਹਾਂਜੀ ਕਿਹੜੇ ਹਾਂਜੀ

ਠੀਕ ਹੈ ਸਰ ਹਾਂਜੀ ਜੀ ਥੈਂਕ ਠੀਕ ਹੈ ਸਰ ਬੜੀ ਮਿਹਰਬਾਨੀ ਸਰ ਓਕੇ ਥੈਂਕਯੂ ਸਰ